ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬੋਲ ਰਹੇ ਹਾਂ ਵਧੀਆ ਜੀ ਵਧੀਆ ਤੁਸੀਂ ਸੁਣਾਓ ਅੱਛਾ ਜੀ ਅੱਛਾ ਜੀ ਠੀਕ ਹੈ ਹਾਂਜੀ ਹਾਂਜੀ ਮਿਲ ਜਾਉਗੀ ਹਾਂਜੀ ਮਿਲ ਜਉਗੀ ਤੁਸੀਂ ਕਿੱਦਾਂ ਬਰੈਂਡਡ ਸਮਾਨ ਲੈਣਾ ਕਿ ਨੌਨ ਬਰੈਂਡਡ ਲੈਣਾ ਉਹ ਲੈ ਤੁਸੀਂ ਵਧੀਆ ਦੀ ਟੈਨਸ਼ਨ ਛੱਡ ਦਓ ਤੁਹਾਨੂੰ ਪਤਾ ਆਪਣੇ ਸਟੋਕ ਦੀ ਕਦੀ ਕੰਪਲੇਂਟ ਆਈ ਨਹੀਂ ਸਾਰਾ ਕੁਛ ਹੀ ਵਧੀਆ ਹੈਂ ਆਪਣਾ ਤੁਸੀਂ ਦੱਸ ਕਿੰਨਾ ਤੁਹਾਨੂੰ ਕਿੰਨਾ ਸਮਾਨ ਚਾਹੀਦਾ ਮੈਨੂੰ ਇੱਕ ਵਾਰ ਦੱਸ ਦਓ ਕੁਐਂਟਿਟੀ ਵਗੈਰਾ ਦੱਸ ਦਓ ਅੱਛਾ ਅੱਛਾ ਅਤੇ ਵਰੀ ਵਰੀ ਦੀ ਤੁਹਾਨੂੰ ਕੀ ਚਾਹੀਦਾ ਮਤਲਬ ਕਿੱਦਾਂ ਦੇ ਸੂਟ ਤੁਸੀਂ ਦੇਖਣੇ ਅੱਛਾ ਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਸਾਡੇ ਕੋਲ਼ ਸਾਰਾ ਪਿਆ ਸਾਡੇ ਕੋਲ਼ ਸਾਡੇ ਕੋਲ ਪਹਾੜੀ ਸੂਟ ਵੀ ਆਏ ਹੈ ਜੀ ਕਸ਼ਮੀਰੀ ਸੂਟ ਵੀ ਆਏ ਹੈ ਗਰਮ ਵੈਲਵੇਟ ਆਪਣੇ ਕੋਲ਼ ਸਾਰਾ ਸਟੋਕ ਆਇਆ ਨਵਾਂ ਤੁਸੀਂ ਉਹਦੀ ਟੈਨਸ਼ਨ ਨਾ ਲਓ ਉਹ ਅਤੇ ਸਾਡਾ ਕੰਮ ਹੈ ਕੀ ਕਹਿੰਦੇ ਆਪਣਾ ਤੁਸੀਂ ਹਾਂਜੀ ਹਾਂਜੀ ਬੋਲੋ ਬੋਲੋ ਹਾਂਜੀ ਹਾਂਜੀ ਸਾਰਾ ਸਮਾਨ ਮਿਲਦਾ ਆਪਣੇ ਅਤੇ ਮੈਂ ਪੁੱਛ ਰਿਹਾ ਸੀ ਤੁਸੀਂ ਇਹ ਮੈਨੂੰ ਦੱਸੋ ਜਿਹੜਾ ਤੁਸੀਂ ਕਹਿ ਰਹੇ ਹੋ ਸੂਟ ਵਗੈਰਾ ਲਾਉਣੇ ਹੈ ਤੁਸੀਂ ਰਿਸ਼ਤੇਦਾਰਾਂ ਨੂੰ ਉਹ ਆਪਾਂ ਕਿਹੜੇ ਬਰੈਂਡ ਦਾ ਪ੍ਰੈਫਰ ਕਰਦੇ ਹਾਂ ਆਪਾਂ ਕਿਹੜਾ ਬਰੈਂਡ ਪਾਉਣਾ ਪਸੰਦ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਤਾਂ ਆਪਾਂ ਸਾਈਜ਼ ਸਾਈਜ਼ ਕਿਹੜਾ ਦੇਖਦੇ ਪਏ ਹੈ ਜ਼ਿਆਦਾਤਰ ਹਾਂ ਫ੍ਰੀ ਸਾਈਜ਼ ਮੈਂ ਚਲੋ ਚਲੋ ਕੋਈ ਗੱਲ ਨਹੀਂ ਮੈਂ ਆਪਣਾ ਸਟੋਕ ਚੈੱਕ ਕਰ ਲਉਂਗਾ ਕੋਈ ਗੱਲ ਨਹੀਂ ਮੈਂ ਸਟੋਕ ਆਪਣਾ ਸਾਰਾ ਚੈੱਕ ਕਰ ਲਉਂਗਾ ਉਹਦੀ ਤੁਸੀਂ ਟੈਨਸ਼ਨ ਨਾ ਲਓ ਬਿਲਕੁਲ ਵੀ ਅਤੇ ਸੂਟ ਵੀ ਆਪਣੇ ਕੋਲ਼ ਕਿੰਨੇ ਕੁ ਚਾਈਦੇ ਹੈ ਸੂਟ ਕਿੰਨੇ ਚਾਈਦੇ ਹੈ ਆਪਾਂ ਨੂੰ ਅੱਛਾ ਅੱਛਾ ਹਾਂ ਹਾਂ ਹਾਂ ਠੀਕ ਹੈ ਠੀਕ ਹੈ ਚਲੋ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਨਾ ਸਾਰੇ ਸਮਾਨ ਦੀ ਲਿਸਟ ਬਣਾ ਕੇ ਭੇਜ ਦਿਓ ਜਿਹੜਾ ਜਿਹੜਾ ਤੁਹਾਨੂੰ ਚਾਈਦਾ ਅਤੇ ਮੈਂ ਉਹ ਠੀਕ ਹੈ ਨਾ ਮੈਂ ਫਿਰ ਉਸ ਹਿਸਾਬ ਨਾਲ ਚੈੱਕ ਕਰਕੇ ਤੁਹਾਨੂੰ ਦੱਸ ਦਉਂਗਾ ਵਿਜ਼ਿਟ ਤੁਸੀਂ ਜਦੋਂ ਮਰਜ਼ੀ ਆ ਜਾਓ ਆਪਣੀ ਦੁਕਾਨ 'ਤੇ ਤੁਹਾਡੀ ਆਪਣੀ ਦੁਕਾਨ ਹੈ ਜੀ ਮੈਨੂੰ ਦੋ ਦੋ ਰੇਟ ਤੁਹਾਨੂੰ ਪਤਾ ਹੀ ਹੈ ਜੀ ਇੱਕ ਤਾਂ ਸਰਦੀਆਂ ਚੱਲੀਆਂ ਆਪਣਾ ਸੇਲਸ ਤਾਂ ਉੱਦਾਂ ਹੀ ਲੱਗੀ ਹੋਈ ਹੈ ਨਾਲੇ ਤੁਸੀਂ ਆ ਜੋ ਸਮਾਨ ਸਮੁਨ ਆਪਣਾ ਕਢਵਾ ਲਓ ਮੈਂ ਤੁਹਾਨੂੰ ਬੈਸਟ ਰੇਟ ਹੀ ਲਾਊਂਗਾ ਤੁਸੀਂ ਰੇਟ ਵੱਲੋਂ ਬਿਲਕੁਲ ਭਾਜੀ ਮੈਂ ਕਿਹਾ ਤੁਸੀਂ ਜਿੰਨਾ ਸਮਾਨ ਲੈਣਾ ਤੁਸੀਂ ਆਪਣੀ ਦੁਕਾਨ ਸਮਝ ਕੇ ਆਓ ਤੁਸੀਂ ਚੱਕਰ ਹੀ ਨਾ ਰੱਖੋ ਰੇਟ ਮੈਂ ਤੁਹਾਨੂੰ ਬੈਸਟ ਲਾਊਂਗਾ ਬਿਲਕੁਲ ਯਾਰ ਤੁਸੀਂ ਜਦੋਂ ਮਰਜ਼ੀ ਆਇਓ ਸਾਨੂੰ ਦੋ ਦਿਨ ਦਾ ਮੈਨੂੰ ਇੱਕ ਦੋ ਦਿਨ ਦਾ ਟੈਮ ਦੇ ਦਓ ਆਪਣੀ ਲਿਸਟ ਭੇਜ ਦਓ ਮੈਂ ਇੱਕ ਵਾਰ ਆਪਣਾ ਸਾਰਾ ਸਟੋਕ ਸਟੂਕ ਚੈੱਕ ਕਰ ਲਵਾਂ ਠੀਕ ਹੈ ਅਤੇ ਤੁਸੀਂ ਮੈਨੂੰ ਵਟਸਐਪ 'ਤੇ ਲਿਸਟ ਭੇਜ ਦਇਓ ਮੈਂ ਤੁਹਾਨੂੰ ਉਸੇ ਨੰਬਰ ਮੈਸਜ ਜਾਂ ਕੋਲ ਕਰ ਦਊਂਗਾ ਆਉਣ ਲਈ ਤੁਸੀਂ ਆਓ ਅਰਾਮ ਨਾਲ ਆਪਣਾ ਬੈਠੋ ਸਮਾਨ ਸਮੁਨ ਆਪਣਾ ਦੇਖ ਲਿਓ ਹਾਂਜੀ ਮਿਲ ਜਾਂਦੇ ਹੈ ਕਿੱਦਾਂ ਦੇ ਚਾਹੀਦੇ ਤੁਹਾਨੂੰ ਨਹੀਂ ਰੈਡੀਮੇਟ ਆਪਣੇ ਕੋਲ ਰੈਡੀਮੇਟ ਵੀ ਪਏ ਹੈ ਅਤੇ ਤੁਸੀਂ ਸਿਲਵਾਈ ਲੈਣੀ ਹੈ ਤਾਂ ਆਪਾਂ ਸਿਲੇ ਹੋਏ ਦੇ ਦਿੰਦੇ ਹਾਂ ਉਹ ਤੁਹਾਡੀ ਆਪਣੀ ਮਰਜ਼ੀ ਹੈ ਜੀ ਤੁਸੀਂ ਉੱਦਾਂ ਲੈਣੇ ਆ ਹਾਂਜੀ ਹਾਂਜੀ ਤੁਸੀਂ ਨਿਸ਼ਚਿੰਤ ਹੋ ਜਾਓ ਜੀ ਜਦੋਂ ਮਰਜ਼ੀ ਆਓ ਹਾਂ ਹਾਂ ਹਾਂ ਬਸ ਹਾਂਜੀ ਹਾਂਜੀ ਸਾਰਾ ਮਿਲਦਾ ਆਪਣੇ ਕੋਲ ਤੁਹਾਨੂੰ ਪਤਾ ਹੀ ਹੈ ਸਾਰਾ ਮਿਲਦਾ ਆਪਣੇ ਬੱਚਿਆਂ ਦਾ ਕੋਈ ਨਹੀ ਮਿਲਦੇ ਆਪਣੇ ਕੋਲ ਆਪਣੇ ਕੋਲ ਵੈਸਟਰਨ ਵੀ ਪਿਆ ਟ੍ਰੈਡੀਸ਼ਨਲ ਵੀ ਪਿਆ ਆਪਣੇ ਕੋਲ ਸਾਰੇ ਕੱਪੜੇ ਪਏ ਹੈ ਤੁਸੀਂ ਜਦੋਂ ਮਰਜ਼ੀ ਆਓ ਦੇਖੋ ਜੀ ਸਮਾਨ ਨਾ ਘਰੇ ਵੀ ਭਿਜਵਾ ਦਿੰਨਾ ਲੇਕਿਨ ਚੱਕਰ ਇਹ ਹੈ ਆਪਣਾ ਸਮਾਨ ਜ਼ਿਆਦਾ ਹੈ ਆਪਾਂ ਦੇਖ ਦੁੱਖ ਕੇ ਲੈਣਾ ਠੀਕ ਹੈ ਤੁਸੀਂ ਇੱਕ ਵਾਰ ਸਟੋਰ 'ਤੇ ਵਿਜ਼ਿਟ ਹੀ ਕਰ ਲਓ ਸਟੋਰ ਤਾਂ ਤੁਹਾਨੂੰ ਪਤਾ ਹੀ ਹੈ ਕਿੱਥੇ ਹੈ ਹਾਂਜੀ ਹਾਂਜੀ ਹਾਂਜੀ ਤੁਸੀਂ ਸ਼ਾਮ ਦੇ ਟਾਈਮ ਜਦੋਂ ਮਰਜ਼ੀ ਆ ਜਾਓ ਪੰਜ ਤੋਂ ਸੱਤ ਜਦੋਂ ਮਰਜ਼ੀ ਆ ਜਾਓ ਆਪਣਾ ਉਸ ਟਾਈਮ ਕੰਮ ਥੋੜ੍ਹਾ ਘੱਟ ਹੀ ਹੁੰਦਾ ਠੀਕ ਹੈ ਨਾ ਚਲੋ ਫ਼ਿਰ ਮੈਂ ਤੁਸੀਂ ਆ ਜੋ ਸਟੋਰ 'ਤੇ ਆਪਾਂ ਗੱਲ ਕਰ ਲੈਂਦੇ ਹਾਂ ਠੀਕ ਹੈ ਜੀ ਚਲੋ ਜੀ ਚੰਗਾ ਜੀ ਰੱਬ ਰਾਖਾ